ਮੈਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਕਦਰ ਹੈ ਉਹ ਆਪਣੇ ਸਮੇਂ ਦੀ ਕਰਦਾ ਕਿ ਜਿਵੇਂ ਮੇਰੇ ਫਾਦਰ ਸਾਹਿਬ ਅਤੇ ਹੋਰ ਮੇਰੇ ਅਧਿਆਪਕ ਵੀ ਕਹਿੰਦੇ ਨੇ ਕਿ ਜੇ ਤੁਸੀਂ ਸਮੇਂ ਨੂੰ ਬਰਬਾਦ ਕਰੋਗੇ ਤਾਂ ਸਮਾਂ ਤੁਹਾਨੂੰ ਬਰਬਾਦ ਕਰ ਦੇਵੇਗਾ ਅਤੇ ਇਸ ਲਈ ਜੋ ਸਮਾਂ ਹੈ ਆਪਣਾ ਤਾਂ ਬਿਲਕੁਲ ਕਦੇ ਵੀ ਇੱਕ ਸੈਕਿੰਡ ਵੀ ਖਰਾਬ ਨਾ ਕਰੋ ਜੇਕਰ ਕੋਈ ਬੰਦਾ ਵਿਹਲਾ ਬਹਿੰਦਾ ਹੈ ਜਾਂ ਉਹਦੀ ਥਾਂ 'ਤੇ ਕੋਈ ਬੇਕਾਰ ਜਾਂ ਕੋਈ ਏਰਾ ਗੇਰਾ ਕੰਮ ਕਰਦੇ ਜਿਹਦੇ ਨਾਲ ਕੋਈ ਵੀ ਫਾਇਦਾ ਨਹੀਂ ਹੁੰਦਾ ਤਾਂ ਉਹ ਆਪਣੀ ਜ਼ਿੰਦਗੀ ਦਾ ਇੱਕ ਦਿਨ ਨਹੀਂ ਉਹ ਬਹੁਤ ਜ਼ਿਆਦਾ ਵੱਡਾ ਆਪਣਾ ਦਿਨ ਵਡ ਖਰਾਬ ਕਰਦਾ ਹੈ ਅਤੇ ਉਹੀ ਸਮਾਂ ਉਹ ਜੇ ਕਿਸੇ ਚੰਗੇ ਕੰਮ 'ਚ ਲਾਵੇ ਅਤੇ ਉਹ ਕੰਮ ਨੂੰ ਰੋਜ਼ ਕਰਦਾ ਰਵੇ ਭਾਵੇਂ ਉਹ ਕੰਮ ਛੋਟਾ ਹੀ ਹੋਵੇ ਤਾਂ ਇੱਕ ਨਾ ਇੱਕ ਦਿਨ ਉਹ ਸ਼ਾਇਦ ਆਪਣੀ ਜ਼ਿੰਦਗੀ ਦਾ ਉਹ ਮੁਕਾਮ ਹਾਸਿਲ ਕਰ ਸਕਦਾ ਹੈ ਜਿਹੜਾ ਕਿ ਉਹ ਹਾਸਿਲ ਕਰਨਾ ਚਾਹੁੰਦਾ ਹੈ ਪਰ ਜੇ ਉਹ ਸਮਾਂ ਉਹੀ ਖਰਾਬ ਕਰੇਗਾ ਤਾਂ ਉਹੀ ਇੱਕ ਕਹਾਵਤ ਹੋਊਗੀ ਉਹ ਸਮੇਂ ਨੂੰ ਬਰਬਾਦ ਕਰੇਗਾ ਅਤੇ ਸਮਾਂ ਉਹਨੂੰ ਬਰਬਾਦ ਕਰੇਗਾ